ਮੈਨੂੰ ਯਾਦ ਹੈ ਕਿ ਸਕੂਲ ਵਿੱਚ ਮੇਰੇ ਨਾਲ਼ ਇੱਕ ਅਜਿਹੀ ਚੁਣੌਤੀਪੂਰਨ ਘਟਨਾ ਵਾਪਰੀ ਸੀ ਜਿੱਦਾਂ ਕੀ ਮੇਰਾ ਪ੍ਰੋਜੈਕਟ ਬਿਜਲੀ ਦੇ ਅਧਾਰਤ ਸੀ ਮੈਂ ਇੱਕ ਵਿੰਡ ਮਿੱਲ ਦਾ ਥ੍ਰੀ ਡੀ ਪ੍ਰੋਜੈਕਟ ਬਣਾਇਆ ਸੀ ਜੇ ਮੇਰੇ ਪ੍ਰੋਜੈਕਟ ਦੀਆਂ ਤਾਰਾਂ ਆਪਸ ਵਿੱਚ ਭਿੜਨ ਨਾਲ ਪ੍ਰੋਜੈਕਟ ਦੇ ਵਿੱਚੋਂ ਧੂੰਆਂ ਉੱਠ ਗਿਆ ਸੀ ਤਾਰਾਂ ਆਪਸ ਵਿੱਚ ਭਿੜਨ ਨਾਲ ਉੱਥੇ ਦਸ ਬੰਦਿਆਂ ਦੀ ਟੀਮ ਮੇਰੇ ਨਾਲ ਸੀ ਇਸ ਤਰੀਕੇ ਨਾਲ ਅਸੀਂ ਉਹਨਾਂ ਉਸਦੀ ਬੜੇ ਔਖੇ ਢੰਗ ਨਾਲ ਸੰਭਾਲ ਕੀਤੀ ਫਿਰ ਅਸੀਂ ਉਹ ਬਿਜਲੀ ਫੈਲਣ ਬਿਜਲੀ ਦਾ ਧਮਾਕਾ ਹੋਣ ਤੋਂ ਬਚਾਇਆ ਸੀ